ਨਹੀਂ ਖਾਣਾ ਬਣਾਉਣਾ ਸਿਰਫ ਔਰਤਾਂ ਦਾ ਕੰਮ ਹੀ ਨਹੀਂ ਹੈ ਇਸ ਵਿੱਚ ਘਰ ਦੇ ਸਾਰੇ ਮੈਂਬਰ ਆਪਣਾ ਯੋਗਦਾਨ ਦੇ ਸਕਦੇ ਹਨ ਖਾਣਾ ਬਣਾਉਣ ਵਿੱਚ ਛੋਟੇ ਬੱਚੇ ਤੋਂ ਲੈ ਕੇ ਫੈਮਲੀ ਦੇ ਬਜ਼ੁਰਗ ਆਦਮੀ ਔਰਤਾਂ ਸਾਰੇ ਹੀ ਆਪਣਾ ਆਪਣਾ ਹਿੱਸਾ ਪਾ ਸਕਦੇ ਹਨ ਜਿਵੇਂ ਕਿ ਛੋਟੇ ਬੱਚੇ ਜਿਹੜੇ ਆ ਬਿਨਾਂ ਅੱਗ ਵਾਲੀ ਕੁਕਿੰਗ ਕਰ ਸਕਦੇ ਹਨ ਜਿਵੇਂ ਕਿ ਸੈਂਡਵਿਚ ਬਣਾਉਣਾ ਹੈ ਨਾ ਜਾਂ ਕੁਛ ਵੇਲਪੂਰੀ ਬਣਾਉਣਾ ਇੱਦਾਂ ਦੇ ਛੋਟੇ ਛੋਟੇ ਕੰਮ ਜਿਨ੍ਹਾਂ ਵਿੱਚ ਅੱਗ ਦਾ ਇਸਤੇਮਾਲ ਨਹੀਂ ਹੁੰਦਾ ਉਹ ਛੋਟੇ ਬੱਚਿਆਂ ਨੂੰ ਵੀ ਆਉਣੇ ਚਾਹੀਦੇ ਹਨ ਤਾਂ ਕਿ ਕਦੇ ਅਗਰ ਘਰ ਦੇ ਵਿੱਚ ਮਾਂ ਨਹੀਂ ਹੈ ਕਿਤੇ ਗਈ ਹੋਈ ਹੈ ਜਾਂ ਕੰਮ ਕਾਰ ਕਰਨ ਵਾਲੀ ਔਰਤ ਹੈ ਤਾਂ ਬੱਚਿਆਂ ਨੂੰ ਭ ਭੁੱਖੇ ਨਾ ਰਹਿਣਾ ਪਏ ਉਹ ਆਪਣਾ ਕੁਝ ਨਾ ਕੁਝ ਬਣਾ ਕੇ ਖਾ ਸਕਦੇ ਹੋਣ ਥੋੜ੍ਹੇ ਜਿਹੇ ਵੱਡੇ ਬੱਚਿਆਂ ਨੂੰ ਜਿਵੇਂ ਕਿ ਪੰਜਵੀਂ ਛੇਵੀਂ ਕਲਾਸ ਦੇ ਬੱਚਿਆਂ ਨੂੰ ਦਾਲ ਅਤੇ ਚਾਵਲ ਬਣਾਉਣੇ ਆਉਣੇ ਚਾਹੀਦੇ ਹਨ ਥੋੜ੍ਹਾ ਹੀ ਸਮਾਂ ਲੱਗਦਾ ਹੈ ਅਤੇ ਇੱਕ ਜਿਹੜਾ ਆ ਪ੍ਰੋਪਰ ਖਾਣਾ ਬਣ ਜਾਂਦਾ ਹੈ ਮੈਗੀ ਤਾਂ ਵੈਸੇ ਅੱਜ ਕੱਲ੍ਹ ਸਾਰੇ ਹੀ ਬੱਚੇ ਬਣਾ ਲੈਂਦੇ ਹਨ ਪਰ ਇਹ ਕੋਈ ਹੈਲਦੀ ਫੂਡ ਨਹੀਂ ਹੈ ਬੱਚਿਆਂ ਨੂੰ ਖਿਚੜੀ ਬਣਾਉਣੀ ਦਾਲ ਬਣਾਉਣੀ ਚੌਲ ਬਣਾਉਣੇ ਅਤੇ ਆਲੂ ਉਬਾਲਣੇ ਉਬਲੀਆਂ ਚੀਜ਼ਾਂ ਬਣਾਉਣੀਆਂ ਆਉਣੀਆਂ ਚਾਹੀਦੀਆਂ ਹਨ ਇੱਕ ਤਾਂ ਉਹ ਹੈਲਦੀ ਹੁੰਦੀਆਂ ਹਨ ਅਤੇ ਦੂਜਾ ਜਿਹੜਾ ਆ ਬੱਚਿਆਂ ਨੂੰ ਬਾਹਰ ਦੇ ਖਾਣੇ ਦੀ ਆਦਤ ਘੱਟ ਲੱਗਦੀ ਹੈ ਅਤੇ ਘਰ ਦੇ ਜਿਹੜੇ ਮਰਦ ਹਨ ਉਹਨਾਂ ਨੂੰ ਵੀ ਕੰਮ ਕਰਨਾ ਚਾਹੀਦਾ ਚਾਹੇ ਕੁੜੀਆਂ ਹੋਣ ਚਾਹੇ ਮੁੰਡੇ ਜੇ ਘਰ ਦੇ ਵਿੱਚ ਬੇਟੀ ਵੀ ਹੈ ਅਤੇ ਬੇਟਾ ਵੀ ਹੈ ਅਤੇ ਦੋਵਾਂ ਨੂੰ ਬਰਾਬਰ ਕੰਮ ਆਉਣੇ ਚਾਹੀਦੇ ਹਨ ਚਾਹ ਬਣਾਉਣੀ ਬੇਟਿਆਂ ਨੂੰ ਵੀ ਆਉਣੀ ਚਾਹੀਦੀ ਹੈ ਅਤੇ ਬੇਟੀਆਂ ਨੂੰ ਵੀ ਆਉਣੀ ਚਾਹੀਦੀ ਹੈ ਅਤੇ ਆਪਣੇ ਲਈ ਇੱਕ ਟਾਈਮ ਦਾ ਖਾਣਾ ਬਣਾਉਣਾ ਦੋਨਾਂ ਨੂੰ ਹੀ ਆਉਣਾ ਚਾਹੀਦਾ ਕਿਉਂਕਿ ਅੱਜ ਕੱਲ੍ਹ ਬੱਚੇ ਪੜ੍ਹ ਲਿਖ ਕੇ ਦੂਸਰੀਆਂ ਵਿਦੇਸ਼ੀ ਕੰਟਰੀਆਂ ਵਿੱਚ ਜਾ ਕੇ ਵਸਣਾ ਚਾਹੁੰਦੇ ਹਨ ਅਤੇ ਉੱਥੇ ਤਾਂ ਫਿਰ ਸਭ ਨੂੰ ਆਪਣਾ ਆਪਣਾ ਕੰਮ ਕਰਨਾ ਪੈਂਦਾ ਹੈ ਖਾਣਾ ਵੀ ਬਣਾਉਣਾ ਪੈਂਦਾ ਹੈ ਫਿਰ ਜਿਸ ਬੱਚੇ ਨੂੰ ਖਾਣਾ ਬਣਾਉਣਾ ਨਹੀਂ ਆਉਂਦਾ ਉਸ ਨੂੰ ਮੁਸ਼ਕਲ ਪ ਪੈਦਾ ਹੁੰਦੀ ਹੈ ਕਿਉਂਕਿ ਬਾਹਰੋਂ ਖਾਣਾ ਲਿਆ ਕੇ ਖਾਣਾ ਬਹੁਤ ਹੀ ਮਹਿੰਗਾ ਪੈਂਦਾ ਹੈ ਹਾਂਜੀ ਸਾਡੇ ਪਰਿਵਾਰ ਦੇ ਜਿਹੜੇ ਹੈ ਮਰਦ ਵੀ ਖਾਣਾ ਬਣਾਉਂਦੇ ਹਨ ਮੇਰਾ ਬੇਟਾ ਰਾਜਮਾਂਹ ਚੌਲ ਬਹੁਤ ਵਧੀਆ ਬਣਾ ਲੈਂਦਾ ਹੈ ਕਿਉਂਕਿ ਇਹ ਉਹਦੀ ਪਸੰਦੀਦਾ ਖਾਣਾ ਹੈ ਇਕ ਉਹ ਪਨੀਰ ਭੁਰਜੀ ਬਹੁਤ ਵਧੀਆ ਬਣਾ ਲੈਂਦਾ ਹੈ ਜੀਰੇ ਵਾਲੇ ਆਲੂ ਸੋ ਜਿਹੜੀ ਚੀਜ਼ ਬੱਚਿਆਂ ਨੂੰ ਪਸੰਦ ਹੈ ਉਹ ਉਹਨਾਂ ਨੂੰ ਆਪ ਬਣਾਉਣ ਦੀ ਆਦਤ ਵੀ ਹੋਣੀ ਚਾਹੀਦੀ ਹੈ ਮੇਰਾ ਬੇਟਾ ਪਰੌਂਠੇ ਵੀ ਬੜੇ ਵਧੀਆ ਬਣਾ ਲੈਂਦਾ ਹੈ ਸਵੇਰੇ ਪਹਿਲਾਂ ਤਾਂ ਮੈਂ ਰੋਟੀ ਪਕਾ ਕੇ ਜਾਂਦੀ ਸੀ ਉਹਦੀ ਸਵੇਰ ਵਾਸਤੇ ਲੇਕਿਨ ਹੁਣ ਉਹ ਠੰਡੀ ਰੋਟੀ ਨਹੀਂ ਖਾਣਾ ਚਾਹੁੰਦਾ ਅਤੇ ਉਹ ਗਰਮ ਰੋਟੀ ਖਾਣ ਲਈ ਆਪੇ ਬਣਾ ਕੇ ਖਾਂਦਾ ਹੈ